ਹੈਲੋ ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਮੈਂ ਨਾ ਐਕਚੁਲੀ ਪੰਜਾਬ ਦੇ ਵਿੱਚ ਟੂਰਿਸਟ ਤੌਰ 'ਤੇ ਆਇਆ ਹੋਇਆ ਹੈਗਾ ਅਤੇ ਆਪਣਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਮਤਲਬ ਕਿ ਕਿਹੜੀਆਂ ਕਿਹੜੀਆਂ ਮਤਲਬ ਕਿ ਜਾਂ ਪਲੇਸਸ ਪਤਾ ਜਿਨ੍ਹਾਂ ਦੇ ਵਿੱਚ ਅਸੀਂ ਵਿਜ਼ਿਟ ਕਰ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਅਤੇ ਮੈਮ ਕੋਈ ਹੋਰ ਪਲੇਸ ਕੋਈ ਬਠਿੰਡੇ ਦੇ ਨੇੜੇ ਕੋਈ ਪੈਂਦੀ ਹੋਵੇ ਹਾਂਜੀ ਹਾਂਜੀ ਹੋਰ ਕੋਈ ਪਲੇਸ ਮਤਲਬ ਇਹਨਾਂ ਤੋਂ ਇਲਾਵਾ ਜੀ ਅਤੇ ਹਾਂਜੀ ਮੈਮ ਇੱਕ ਅਸੀਂ ਜ਼ਰੂਰ ਸੁਣਿਆ ਜਿਹੜਾ ਕਿ ਮਤਲਬ ਕਿ ਇੱਥੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਨਾਲ ਪੈਂਦਾ ਹੈਗਾ ਨੇੜੇ ਸ਼ਾਇਦ ਉਸ ਪਿੰਡ ਦਾ ਨਾਮ ਬੀੜ ਤਲਾਬ ਅਸੀਂ ਉਹ ਜੂ ਦੇ ਬਾਰੇ ਤੁਹਾਨੂੰ ਕੋਈ ਅੱਛਾ ਜੀ

ਠੀਕ ਠੀਕ ਹੈ ਮੈਮ ਠੀਕ ਹੈ ਜੀ ਮੈਮ ਇੱਥੇ ਮਤਲਬ ਹੋਰ ਵੀ ਜਿੱਦਾਂ ਕਿ ਕੋਈ ਹੋਰ ਪਲੇਸਿਸ ਹੋਣਗੀਆਂ ਜਿੱਦਾਂ ਕਿ ਬਠਿੰਡੇ ਦੇ ਵਿੱਚ ਸ਼ੋਪਿੰਗ ਵਗੈਰਾ ਕਰਨ ਨੂੰ ਜਾਂ ਮਤਲਬ ਹਾਂਜੀ ਜਾਂ ਜਿੱਦਾਂ ਕਿ ਆਪਾਂ ਮੌਲ ਤਾਂ ਹੋ ਗਿਆ ਸਿਨੇਮਾ ਵਗੈਰਾ ਹੋ ਗਿਆ

ਠੀਕ ਹੈ ਜੀ ਜੀ ਜੀ ਜੀ ਅਤੇ ਜਿੱਦਾਂ ਕਿ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਗ੍ਰੀਨ ਸਿਟੀ ਦੇ ਨਾਮ ਨਾਲ ਹੈ ਨਾ ਇੱਕ ਮੈਂ ਸੁਣਿਆ ਹੈਗਾ ਕਿ ਅਸੀਂ ਸੁਣਿਆ ਕਿ ਗ੍ਰੀਨ ਸਿਟੀ ਦੇ ਨਾਮ ਨਾਲ ਇੱਕ ਸਿਟੀ ਜਾਣੀ ਜਾਂਦੀ ਹੈ ਹੈ ਨਾ ਜੀ ਅਤੇ ਉੱਥੇ ਵੀ ਕਹਿੰਦੇ ਵੀ ਰੂਮ ਵਗੈਰਾ ਅਵੇਲੇਬਲ ਨੇ ਟੂਰਿਸਟ ਦੇ ਲਈ ਠੀਕ ਹੈ ਠੀਕ ਹੈ ਮੈਮ ਥੈਂਕਯੂ